ਹੈਲੋ ਹਾਂਜੀ ਭਾਅ ਜੀ ਕੌਣ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਬੋਲੋ ਭਾਅ ਜੀ ਠੀਕ ਠਾਕ ਹੋ ਅੱਛਾ ਗੁਰਦਾਸਪੁਰ ਰਹਿੰਦੇ ਨਹੀਂ ਤੁਸੀਂ ਹਾਲੇ ਕਿੱਥੇ ਪਹੁੰਚੇ ਹੋ ਹਾਲੀ ਅੱਛਾ ਅੱਛਾ ਠੀਕ ਹੈ ਮੈਂ ਤੁਹਾਨੂੰ ਨਾ ਦੱਸ ਦਿੰਦਾ ਜਗ੍ਹਾ ਜਿਹੜੀ ਇੱਥੇ ਦੀ ਬੜੀ ਫੇਮਸ ਹੈ ਇੱਥੇ ਨਾ ਜਿਹੜਾ ਗੁਰਦਾਸਪੁਰ ਵਿੱਚ ਇੱਕ ਹੈਗਾ ਫਿਸ਼ ਪਾਰਕ ਉੱਥੇ ਮੈਂ ਕਹਿੰਦਾ ਸਭ ਤੋਂ ਵਧੀਆ ਜਗ੍ਹਾ ਉਹ ਦੇਖਣ ਵਾਲੀ ਜਗ੍ਹਾ ਉੱਥੋਂ ਉੱਥੋਂ ਤਾਂ ਦੂਰ ਦੂਰ ਦੇ ਲੋਕ ਆਉਂਦੇ ਹੈ ਹਾਂਜੀ ਹਾਂਜੀ ਹਾਂਜੀ ਮੈਂ ਤੈਨੂੰ ਦੱਸਦਾ ਪਹਿਲੇ ਸੁਣ ਤਾਂ ਲਓ ਇਹ ਗੱਲ ਪੂਰੀ ਮੈਂ ਕਹਿ ਰਿਹਾ ਸੀ ਇਹ ਜਿਹੜਾ ਫਿਸ਼ ਪਾਰਕ ਹੈ ਨਾ ਉੱਥੇ ਬੈਠਣ ਦੀ ਵੀ ਜਗ੍ਹਾ ਬਹੁਤ ਅੱਛੀ ਅੱਛੀ ਹੈ ਤੁਸੀਂ ਕਹਿਣਗੇ ਕਿ ਭਾਅ ਜੀ ਨਜ਼ਾਰੇ ਆਉਣਗੇ ਪੂਰੇ ਅਤੇ ਖਾਣ ਪੀਣ ਦਾ ਵੀ ਭਾਜੀ ਬਹੁਤ ਅੱਛਾ ਹੈ ਸਾਫ ਸੁਥਰਾ ਹੈ ਹਾਂਜੀ ਹਾਂਜੀ ਅਤੇ ਦੂਜਾ ਇੱਕ ਹੈਗਾ ਘੱਲੂ ਘਾਰਾ ਸਾਹਿਬ ਇੱਥੇ ਵੀ ਲੋਕ ਆਉਂਦੇ ਜਾਂਦੇ ਅਤੇ ਬਹੁਤ ਅੱਛੀ ਜਗ੍ਹਾ ਹੈ ਮੈਂ ਤੁਹਾਨੂੰ ਇੱਥੇ ਵੀ ਘੁਮਾਊਂਗਾ ਸਪੈਸ਼ਲ ਇੱਧਰ ਹਾਂਜੀ ਹਾਂਜੀ ਹਾਂਜੀ ਤੇ ਇੱਕ ਹੈਗਾ ਪੰਡੋਰੀ ਧਾਮ ਉੱਥੇ ਇੱਕ ਮੰਦਰ ਹੈ ਭਾਅ ਜੀ ਉੱਧਰੋਂ ਮੈਂ ਕਹਿੰਦਾ ਭਾਜੀ ਉੱਧਰੋਂ ਇੰਨੇ ਦੂਰ ਤੋਂ ਬੰਦੇ ਆਉਂਦੇ ਹਾਂਜੀ ਹਾਂਜੀ ਹਾਂਜੀ ਮੈਂ ਤੁਹਾਨੂੰ ਉਹਦੀ ਉਹਦੀ ਹੀ ਗੱਲ ਕਰ ਰਿਹਾ ਮੈਂ ਕਹਿ ਰਿਹਾ ਭਾਅ ਜੀ ਮਤਲਬ ਬੰਦੇ ਇੰਨੇ ਦੂਰੋਂ ਦੂਰੋਂ ਆਉਂਦੇ ਨਾ ਉੱਥੋਂ ਮੱਥਾ ਟੇਕਣ ਤੁਸੀਂ ਮੰਨ ਨਹੀਂ ਸਕਦੇ ਕਿੰਨੀ ਜਨਤਾ ਆਉਂਦੀ ਹੈ ਇਸ ਟਾਈਮ 'ਤੇ ਸਾਡੇ ਉੱਥੇ ਇੱਕ ਹੈਗੇ ਨੋਨ ਆਪਾਂ ਤੁਹਾਡੇ ਛੇਤੀ ਮੰਦਰ ਦੇ ਦਰਸ਼ਨ ਕਰ ਕਰਵਾ ਦਊਂਗੇ ਸਾਡੇ ਇੱਥੇ ਹੈਗੇ ਉੱਥੇ ਨੋਨ ਤੁਸੀਂ ਟੈਂਸ਼ਨ ਨਾ ਲਓ ਬੱਸ ਤੁਸੀਂ ਛੇਤੀ ਆ ਜਾਣਾ ਹਾਂਜੀ ਹਾਂਜੀ ਤੇ ਹੋਰ ਬਸ ਭਾਅ ਜੀ ਹਾਲੇ ਤਾਂ ਇਹ ਹੀ ਹੈ ਤਿੰਨ ਖਾਸ ਅਤੇ ਮੌਕੇ 'ਤੇ ਪ ਪਤਾ ਮੈਂ ਮਤਲਬ ਤੁਹਾਨੂੰ ਦੱਸ ਦਿਆਂਗਾ ਹੋਰ ਠੀਕ ਹੈ ਅਤੇ ਤੁਸੀਂ ਜਦ ਮੈਨੂੰ ਨਹੀਂ ਮੈਂ ਕਿਹਾ ਜਦ ਤੁਸੀਂ ਮੈਨੂੰ ਮਿਲੋਗੇ ਨਾ ਤਾਂ ਫਿਰ ਤੁਹਾਨੂੰ ਮੈਂ ਹੋਰ ਵੀ ਦੱਸਾਂਗਾ ਠੀਕ ਹੈ ਹਾਂਜੀ ਠੀਕ ਆ ਭਾਅ ਜੀ ਓਕੇ ਓਕੇ